ਸਾਡੇ ਖੇਤਰ ਵਿੱਚ ਇੱਕ ਖੇਤੀਬਾੜੀ ਹੀ ਹੈ ਜੋ ਇੱਕ ਕੁਦਰਤੀ ਸ੍ਰੋਤ ਹੈ ਜੋ ਕਿ ਇੱਕ ਵਧੀਆ ਕੁਦਰਤੀ ਸ੍ਰੋਤ ਹੈ ਲੋਕ ਆਪਣੇ ਖੇਤਾਂ ਵਿੱਚ ਆਪਣੀ ਜ਼ਮੀਨਾਂ ਵਿੱਚ ਕ ਬਹੁਤ ਸਾਰਾ ਅਨਾਜ ਉਗਾਉਂਦੇ ਹਨ ਜਿਵੇਂ ਕਣਕ ਚਾਵਲ ਮੱਕੀ ਆਦਿ ਇਹ ਸਭ ਵੇਚ ਕੇ ਮੰਡੀ ਵਿੱਚ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਵਧੀਆ ਕਰ ਰਹੇ ਹਨ